ਸਤਿ ਸ਼੍ਰੀ ਅਕਾਲ ਸਰ ਜੀ ਸਰ ਜੀ ਅਸੀਂ ਨਾ ਤੁਹਾਡੇ ਕੋਲੋਂ ਮਤਲਬ ਕਿ ਕੈਂਟਰ ਮੰਗਵਾਈ ਸੀ ਗਰਮ ਪਾਣੀ ਵਾਸਤੇ ਅਤੇ ਉਹ ਨਾ ਥੌੜ੍ਹੀ ਖਰਾਬ ਜਿਹੀ ਨਿਕਲੀ ਆ ਅਸੀਂ ਦੋ ਤਿੰਨ ਵਾਰੀ ਪਾਣੀ ਗਰਮ ਕੀਤਾ ਅਤੇ ਠੀਕ ਪਾਣੀ ਗਰਮ ਹੋਇਆ ਤੀਸਰੇ ਤੀਸਰੇ ਦਿਨ ਪਾਣੀ ਗਰਮ ਕੀਤਾ ਅਤੇ ਉਹ ਨਾ ਮਤਲਬ ਕਿ ਪਤਾ ਨਹੀਂ ਜਾਂ ਸੜਗੀ ਜਾਂ ਪਤਾ ਨਹੀਂ ਕੀ ਗੱਲ ਆ ਉਹ ਪਾਣੀ ਨਹੀਂ ਗਰਮ ਹੋ ਰਿਹਾ ਅਤੇ ਅਸੀਂ ਤੁਹਾਨੂੰ ਮਤਲਬ ਕਿ ਪੈਸੇ ਵੀ ਪੂਰੇ ਦਿੱਤੇ ਆ ਤੁਸੀਂ ਨਾ ਜਾਂ ਸਾਨੂੰ ਮਤਲਬ ਕਿ ਕੈਂਟਲ ਹੋਰ ਦੇ ਦਿਓ ਅਤੇ ਜੇ ਨਹੀਂ ਤਾਂ ਫਿਰ ਸਾਨੂੰ ਕੰਪਲੀਟ ਕਰਨੀ ਪਏਗੀ ਜਾਂ ਫਿਰ ਸਾਨੂੰ ਉਹਦੀ ਜਗ੍ਹਾ 'ਤੇ ਹੋਰ ਕੋਈ ਮਤਲਬ ਕਿ ਦਿੱਤੀ ਜਾਵੇ ਜਿਹਦੇ ਨਾਲ ਮਤਲਬ ਕਿ ਪਾਣੀ ਗਰਮ ਹੋ ਸਕੇ ਇੱਕ ਤਾਂ ਅਸੀਂ ਬਾਰਾਂ ਤਰੀਕ ਨੂੰ ਮੰਗਵਾਈ ਸੀ ਤੁਸੀਂ ਸਾਨੂੰ ਭੇਜੀ ਚੌਦਾਂ ਤਰੀਕ ਅਤੇ ਹੁਣ ਨਾ ਮਤਲਬ ਕਿ ਪਾਣੀ ਗਰਮ ਕਰਨ ਵਾਸਤੇ ਸਾਨੂੰ ਕੇਤਲੀ ਦੂਸਰੀ ਦਿੱਤੀ ਜਾਏ ਕਿ ਉਹ ਵਾਲੀ ਖਰਾਬ ਹੋ ਗਈ ਹੈ ਅਤੇ ਜੇ ਨਹੀਂ ਦੇ ਸਕਦੇ ਤੁਸੀਂ ਤਾਂ ਅਸੀਂ ਤੁਹਾਡੀ ਕੰਪਲੇਟ ਕਰ ਸਕਦੇ ਆ ਨਾ ਠੀਕ ਹੈ ਸਰ ਜੀ ਤੁਸੀਂ ਕਦੋਂ ਤੱਕ ਭੇਜ ਰਹੇ ਹੋ ਹਾਂ ਠੀਕ ਹੈ